ਪੰਜਾਬ ਵਿੱਚ ਟੈਕਨੋਲਜੀ ਸੈਕਟਰ ਦੇ ਬਾਰੇ ਜੇ ਗੱਲ ਕਰੀਏ ਤਾਂ ਸਾਨੂੰ ਅੱਜ ਕੱਲ੍ਹ ਬਹੁਤ ਹੀ ਸਾ ਸੌਖੇ ਤਰੀਕੇ ਦੇ ਨਾਲ ਸਾਨੂੰ ਹਰ ਇੱਕ ਚੀਜ਼ ਦੀ ਸ ਇਨਫੋਰਮੇਸ਼ਨ ਬਹੁਤ ਛੇ ਮਿਲ ਜਾਂਦੀ ਹੈ ਲਾਈਕ ਕਿ ਟੈਲੀਵਿਜ਼ਨ ਦੇ ਵਿੱਚ ਖਬਰਾਂ ਰਾਹੀਂ ਸਾਨੂੰ ਹਰ ਇੱਕ ਖੇਤਰ ਦੀ ਹਰ ਇੱਕ ਭਾਰਤ ਹੀ ਨਹੀਂ ਭਾਰਤ ਤੋਂ ਬਾਹਰ ਵੀ ਸਾਨੂੰ ਹਰ ਤ ਪ੍ਰਾਂਤ ਦੀ ਹਰ ਇੱਕ ਵਰਲਡ ਦੇ ਵਿੱਚ ਹਰ ਜਗ੍ਹਾ ਦੀ ਇਨਫੋਰਮੇਸ਼ਨ ਸਾਨੂੰ ਘਰ ਬੈਠੇ ਹੀ ਮਿਲ ਜਾਂਦੀ ਆ ਕਿੱਥੇ ਕੀ ਹੋਇਆ ਕਿੱਥੇ ਕਿਹੜੀ ਘਟਨਾ ਵਾਪਰੀ ਇਹ ਸਾਰੀ ਹੀ ਚੀਜ਼ਾਂ ਸਾਨੂੰ ਹੁਣ ਟੈਲੀਵਿਜ਼ਨ ਰਾਹੀਂ ਸਾਰੀ ਮਿਲ ਜਾਂਦੀਆਂ ਹਨ ਔਰ ਉਦਾ ਦੂਜਾ ਉਪਕਰਨ ਆ ਜਾਂਦਾ ਹੈ ਸਾਡੇ ਕੋਲ ਮੋਬਾਈਲ ਫੋਨ ਮੋਬਾਈਲ ਫੋਨ ਦੇ ਵਿੱਚ ਹੁਣ ਅਜਿਹੇ ਐਪਸ ਆ ਗਏ ਹਨ ਜਿਹਦੇ ਵਿੱਚ ਤੁਸੀਂ ਹਰ ਰੋਜ਼ ਪਲ ਪਲ ਦੀ ਖਬਰ ਚਾਹੇ ਤਾਂ ਤੁਸੀਂ ਆਪਣੇ ਸ਼ਹਿਰ ਦੀ ਹੋਵੇ ਚਾਹੇ ਤੁਸੀਂ ਆਪਣੇ ਦੇਸ਼ ਦੀ ਹੋਵੇ ਚਾਹੇ ਤੁਸੀਂ ਵਰਲਡ ਦੀ ਹੋਵੇ ਹਰ ਤਰ੍ਹਾਂ ਦੀ ਇੱਕ ਖਬਰ ਤੁਹਾਡੇ ਫੋਨ ਦੇ ਵਿੱਚ ਤੁਹਾਨੂੰ ਮਿਲ ਜਾਂਦੀ ਏ ਇਹਦੇ ਨਾਲ ਸਾਨੂੰ ਇਹ ਹੋ ਜਾਂਦਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਜੇ ਕੋਈ ਵੀ ਇੱਦਾਂ ਦੀ ਕੋਈ ਘਟਨਾ ਜਾਂ ਫਿਰ ਕਿਸੇ ਤਰ੍ਹਾਂ ਦਾ ਵੀ ਕੁਛ ਵਧਾ ਚੜਾਅ ਜਾਂ ਕੁਛ ਵੀ ਉਤਾਰ ਚੜਾਅ ਆਉਂਦਾ ਆ ਜਾਂ ਕਿਸੇ ਤਰ੍ਹਾਂ ਦਾ ਮਾਹੌਲ ਠੀਕ ਹੈ ਕੁਛ ਬ ਹੋਇਆ ਹੈ ਉਹ ਸਾਰੀ ਚੀਜ਼ਾਂ ਸਾਨੂੰ ਇਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਟੈਲੀਵਿਜ਼ਨ ਔਰ ਮੋਬਾਇਲ ਫੋਨ ਰਾਹੀਂ ਸਾਨੂੰ ਮਿਲ ਜਾਂਦੀ ਇਹਦੇ ਨਾਲ ਸਾਨੂੰ ਕੁਛ ਚੀਜ਼ਾਂ ਇੱਦਾਂ ਦੀਆਂ ਵੀ ਹੁੰਦੀਆਂ ਜਿਹਦੇ ਵਿੱਚ ਅਸੀਂ ਮਨੋਰੰਜਨ ਦਾ ਸਾਧਨ ਬਣ ਜਾਂਦਾ ਹੈ ਜਿੱਦਾਂ ਗੱਲ ਕਰੀਏ ਇੰਸਟਾਗ੍ਰਾਮ ਦੇ ਵਿੱਚ ਇੰਸਟਾਗ੍ਰਾਮ ਦੇ ਵਿੱਚ ਸਾਨੂੰ ਕਈ ਇਸ ਤਰ੍ਹਾਂ ਦੀਆਂ ਰੀਲਸ ਵਗੈਰਾ ਮਿਲਦੀਆਂ ਜੋ ਕਿ ਫਨੀ ਔਰ ਬਹੁਤ ਵਧੀਆ ਹੁੰਦੀ ਜੋ ਸਾਡੀ ਇੰਟਰਟੇਨਮੈਂਟ ਵੀ ਕਰਦੀਆਂ ਹਨ ਉਸ ਤੋਂ ਇਲਾਵਾ ਯੂਟਿਊਬ ਦੇ ਵਿੱਚ ਸਾਨੂੰ ਕਿਸੀ ਚੀਜ਼ ਦੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਕਿਸੀ ਜੀਅ ਜਾਂ ਕਿਸੀ ਸਥਾਨ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਉਹ ਅਸੀਂ ਬੜੇ ਆਰਾਮ ਦੇ ਨਾਲ ਇਸ ਇਸ ਤੋਂ ਪ੍ਰਾਪਤ ਕਰ ਲੈਂਦੇ ਹਾਂ